ਅੱਜ ਕੱਲ੍ਹ ਲੱਚਰ ਗਾਣੇ ਚੱਲਦੇ ਹੈਗੇ ਆ ਕਿ ਉਹ ਭੈਣ ਭਰਾਵਾਂ 'ਚ ਬੈਠ ਕੇ ਕੋਈ ਸੁਣ ਨਹੀਂ ਸਕਦਾ ਨਾ ਸੁਣਦਾ ਜਦੋਂ ਭੈਣ ਭਰਾ ਬੈਠੇ ਹੁੰਦੇ ਨੇ ਨਾ ਵਿੱਚ ਬਹਿ ਕੇ ਸੁਣ ਸਕਦਾ ਨਾ ਉੱਠ ਸਕਦਾ ਵੀ ਇੰਨੀ ਸ਼ਰਮਿੰਦਗੀ ਹੈ ਨਹੀਂ ਕੋਈ ਸਮਝ ਆਉਂਦੀ ਵੀ ਬਹਿ ਕੇ ਕੀ ਕਰੀਏ ਉੱਠ ਸਕਦੇ ਹਾਂ ਕਿ ਬੈਠ ਸਕਦੇ ਹਾਂ ਨਾ ਬੈਠਣ ਜੋਗੇ ਹੁੰਦੇ ਹਾਂ ਨਾ ਉੱਠ ਸਕਦੇ ਹਾਂ ਇਹੋ ਜਿਹਾ ਕਲਚਰ ਚੱਲ ਰਿਹਾ ਹੈ ਕਿ ਆਪਾਂ ਭੈਣ ਭਰਾਵਾਂ ਦੇ ਵਿੱਚ ਬੈਠ ਕੇ ਸੁਣ ਸਕਦੇ ਹਾਂ ਅਤੇ ਸ਼ਰਮਿੰਦਗੀ ਵੀ ਬਹੁਤ ਮਹਿਸੂਸ ਹੁੰਦੀ ਹੈ ਇਸ ਕਰਕੇ ਕਰਕੇ ਵੀ ਉੱਠਣ ਜੋਗੇ ਵੀ ਨਹੀਂ ਰਹਿੰਦੇ ਬਹਿਣ ਜੋਗੇ ਵੀ ਨਹੀਂ ਰਹਿੰਦੇ